ਪੰਜਾਬੀ ਭਾਸ਼ਾ ਦੀਆਂ ਕੁਝ ਮਤਲਬ ਵਿਲੱਖਣ ਹੀ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਇਸਦੇ ਵਿੱਚ ਕੁਝ ਖੜ੍ਹਵੇਂ ਅੱਖਰ ਹਨ ਜਿਵੇਂ ਕਿ ਯੰਗਾ ਣਾਣਾ ਮੱਮਾ ਅਤੇ ਇਸਦੇ ਜਿਹੜੇ ਪੈਰਾਂ ਦੇ ਵਿੱਚ ਅੱਖਰਾਂ ਦੇ ਵਿੱਚ ਪੈਰਾਂ ਦੇ ਵਿੱਚ ਬਿੰਦੀਆਂ ਵੀ ਲੱਗਦੀਆਂ ਹਨ ਜਿਹੜੀਆਂ ਕਿ ਦੂਜੇ ਅੱਖਰਾਂ ਦੇ ਵਿੱਚ ਨਹੀਂ ਲੱਗਦੀਆਂ ਹਨ